ਹੈਲੋ ਗੁੱਡ ਈਵਨਿੰਗ ਖਾਣੇ ਬਾਰੇ ਗੱਲ ਕਰਨੀ ਜੀ ਮੈਂ ਹਾਂਜੀ ਹਾਂਜੀ ਹਾਂ ਕੀ ਕੀ ਬਣਾਉਣਾ ਅੱਜ ਖਾਣੇ 'ਚ ਲੰਚ 'ਚ ਡਿਨਰ 'ਚ ਓਕੇ ਚਪਾਤੀ ਵੀ ਬਣਾ ਦਿਓ ਅਤੇ ਨਾਲੇ ਕੋਈ ਸਬਜ਼ੀ ਵੀ ਬਣਾ ਲਿਓ ਹਾਂਜੀ ਅਤੇ ਕੁਛ ਮਿ ਮਿੱਠੇ 'ਚ ਵੀ ਬਣਾ ਦਿਓ ਹਾਂ ਮਿੱਠੇ 'ਚ ਬਣਾਉਣਾ ਨਹੀਂ ਨਹੀਂ ਮਿੱਠੇ 'ਚ ਨਹੀਂ ਬਣਾਉਣਾ ਮਿੱਠੇ 'ਚ ਸ਼ੂਗਰ ਹੈ ਨਾ ਤੁਹਾਨੂੰ ਪਤਾ ਮੈਂ ਮਿੱਠਾ ਘੱਟ ਹੀ ਖਾਂਦੀ ਹਾਂ ਹਾਂਜੀ ਮੈਡੀਸਨ ਚੱਲਦੀ ਆ ਮੋਰਨਿੰਗ ਬ੍ਰੇਕਫਾਸਟ ਸੈਂਡਵਿਚ ਵਗੈਰਾ ਬਣਾ ਦਿਓ ਸਿੰਪਲ ਜਿਹੇ ਹਾਂ ਜ਼ਿਆਦਾ ਓਇਲੀ ਨਾ ਕਰਿਓ ਬਸ ਸਿੰਪਲ ਗਰਿਲ ਗਰਿਲ ਸੈਂਡਵਿਚ ਬਣਾ ਦਿਓ ਹਾਂ ਜੀ ਹਾਂਜੀ ਹਾਂਜੀ ਹਾਂਜੀ ਅਤੇ ਕੌਫੀ ਕੌਫੀ ਠੀਕ ਹੈ ਨਹੀਂ ਸੈਲਿਡ 'ਚ ਲੰਚ 'ਚ ਖਾਵਾਂਗੇ ਹਾਂਜੀ ਹਾਂਜੀ ਅਤੇ ਸਵੇਰੇ ਅੱਠ ਸਾਢੇ ਅੱਠ ਵਜੇ ਤੱਕ ਬ੍ਰੇਕਫਾਸਟ ਕਰ ਦਿਓ ਅਤੇ ਹੁਣ ਡਿਨਰ ਵੀ ਕਰ ਦਿਓ ਸਾਢੇ ਕੁ ਸੱਤ ਵਜੇ ਤੱਕ ਠੀਕ ਹੈ ਜ਼ਿਆਦਾ ਹਾਂ ਜ਼ਿਆਦਾ ਓਇਲ ਵਗੈਰਾ ਨਹੀਂ ਪਾਉਣਾ ਸਿੰਪਲ ਜਿਹਾ ਬਣਾਇਓ ਖਾਣਾ ਨਾ ਹਾਂਜੀ ਹਾਂ ਅਤੇ ਫਰੈਸ਼ ਫੂਡ ਬਣਾਇਓ ਸਾਰਾ ਫਰੈਸ਼ ਸਬਜ਼ੀਆਂ ਲਿਆਇਓ ਹਾਂਜੀ ਹਾਂਜੀ ਹਾਂਜੀ ਅਤੇ ਬਸ ਫਿਰ ਲੰਚ ਦਾ ਫਿਰ ਮੈਂ ਸਵੇਰੇ ਦੱਸ ਦਊਂਗੀ ਕੀ ਬਣਾਉਣਾ ਕੱਲ੍ਹ ਨੂੰ ਲੰਚ 'ਚ ਹਾਂਜੀ ਹਾਂਜੀ ਲੰਚ 'ਚ ਕੋਈ ਚਾਵਲ ਵਗੈਰਾ ਸਿੰਪਲ ਬਣਾ ਲਵਾਂਗੇ ਬਣਾ ਦਿਓ ਤੁਸੀਂ ਠੀਕ ਹੈ ਤੁਸੀਂ ਖਾਣਾ ਬਣਦਾ ਫਿਰ ਮੈਨੂੰ ਕੌਲ ਕਰ ਦਿਓ ਓਕੇ ਓਕੇ